ਅ ਹੈਲੋ ਐਮਾਜ਼ੋਨ ਤੋਂ ਗੱਲ ਕਰ ਰਹੇ ਹੋ ਜੀ ਅ ਮੇਰਾ ਇੱਕ ਪਾਰਸਲ ਸੀ ਜੀ ਉਹ ਡਿਲੀਵਰ ਨਹੀਂ ਹੋਇਆ ਉਹਦੇ ਬਾਰੇ ਕੰਪਲੇਂਟ ਲਿਖਾਉਣੀ ਸੀ ਜਦੋਂ ਮੈਂ ਐਪ ਖੋਲ੍ਹ ਰਿਹਾ ਤਾਂ ਉੱਥੇ ਦਿਖਾਈ ਦੇ ਰਿਹਾ ਹੈ ਕਿ ਤੁਹਾਡਾ ਜਿਹੜਾ ਪਾਰਸਲ ਹੈ ਉਹ ਡਿਲੀਵਰ ਹੋ ਚੁੱਕਿਆ ਹੈ ਪਰ ਦਰਅਸਲ ਮੇਰੇ ਕੋਲ ਉਹ ਪਾਰਸਲ ਡਿਲੀਵਰ ਨਹੀਂ ਹੋਇਆ ਤਾਂ ਮੈਂ ਪੁੱਛਣਾ ਚਾਹੁੰਦਾ ਸੀ ਕਿ ਮੇਰਾ ਪਾਰਸਲ ਕਿੱਥੇ ਹੈ ਜੀ ਅਤੇ ਮੇਰਾ ਪਾਰਸਲ ਕਦੋਂ ਤੱਕ ਮੇਰੇ ਕੋਲ ਪਹੁੰਚ ਜੂਗਾ ਦਰਅਸਲ ਉਹ ਪਾਰਸਲ ਮੇਰੇ ਲਈ ਬਹੁਤ ਜ਼ਰੂਰੀ ਹੈ ਜੀ ਮੇਰੇ ਭਾਈ ਨੇ ਉਹਦੇ 'ਚ ਕੁਛ ਸਮਾਨ ਭੇਜਿਆ ਹੈ ਮੈਂ ਐਪ ਦੇ ਉੱਪਰ ਦਿੱਤੇ ਗਏ ਨੰਬਰ 'ਤੇ ਵੀ ਫੋਨ ਕੀਤਾ ਉਹ ਨਹੀਂ ਲੱਗ ਰਿਹਾ ਅਤੇ ਮੈਂ ਜਾਣਨਾ ਚਾਹੂੰਗਾ ਕਿ ਮੇਰਾ ਪਾਰਸਲ ਮੇਰੇ ਤੱਕ ਕਦੋਂ ਤੱਕ ਪਹੁੰਚ ਜੂਗਾ ਜੀ ਕਿਰਪਾ ਕਰਕੇ ਜਲਦੀ ਤੋਂ ਜਲਦੀ ਮੇਰਾ ਕੋਰੀਅਰ ਮੇਰੇ ਤੱਕ ਪਹੁੰਚਾਇਆ ਜਾਵੇ ਜੀ ਉਹ ਮੇਰੇ ਲਈ ਬਹੁਤ ਜ਼ਰੂਰੀ ਹੈ ਉਹ 'ਚ ਮੇਰਾ ਕੁਝ ਬਹੁਤ ਜ਼ਰੂਰੀ ਸਮਾਨ ਹੈ ਜੋ ਮੈਨੂੰ ਚਾਹੀਦਾ ਠੀਕ ਹੈ ਜੀ ਠੀਕ ਹੈ ਧੰਨਵਾਦ ਜੀ